ਅਸੀਂ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਇੱਥੇ ਤਾਂ ਬਹੁਤ ਸਾਰੀਆਂ ਜਗ੍ਹਾ ਨੇ ਅਤੇ ਸਭ ਤੋਂ ਇੱਕ ਨੰਬਰ 'ਤੇ ਹੈ ਅੰਮ੍ਰਿਤਸਰ ਦਾ ਦੁਰਗਿਆਨਾ ਮੰਦਿਰ ਗੁਰਦੁਆਰਾ ਦਰਬਾਰ ਸਾਹਿਬ ਅਤੇ ਰਾਮ ਤੀਰਥ ਇਹ ਤਿੰਨ ਜਗ੍ਹਾ ਦਾ ਸੱਭਿਆਚਾਰਕ ਧਾਰਮਿਕ ਮਹੱਤਵ ਬਹੁਤ ਹੈ ਦਰਬਾਰ ਸਾਹਿਬ ਤਾਂ ਜਦੋਂ ਸਾਡੇ ਘਰ ਕੋਈ ਵੀ ਆਉਂਦਾ ਪ੍ਰਾਹੁਣਾ ਉਹਦੀ ਇੱਕੋ ਖੁਆਹਿਸ਼ ਹੁੰਦੀ ਹੈ ਕਿ ਮੈਨੂੰ ਦਰਬਾਰ ਸਾਹਿਬ ਮੱਥਾ ਟਿਕਾ ਕੇ ਉੱਥੋਂ ਦਾ ਲੰਗਰ ਖਵਾ ਕੇ ਲਿਆਓ ਉੱਥੋਂ ਦਾ ਲੰਗਰ ਸਭ ਤੋਂ ਜ਼ਿਆਦਾ ਸਾਰਿਆਂ ਨੂੰ ਸਵਾਦ ਲੱਗਦਾ ਸਾਰੇ ਇਹ ਹੀ ਕਹਿੰਦੇ ਹੈ ਕਿ ਅਸੀਂ ਆਏ ਹਾਂ ਸਵੇਰੇ ਰਾਤ ਦੀ ਟ੍ਰੇਨ ਤੋਂ ਉਤਰੇ ਹਾਂ ਅਤੇ ਸਵੇਰੇ ਸਾਨੂੰ ਦਰਬਾਰ ਸਾਹਿਬ ਵੀ ਲੈ ਜਾਓ ਦਰਬਾਰ ਸਾਹਿਬ ਜਾ ਕੇ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਉੱਥੇ ਕਈ ਤਰ੍ਹਾਂ ਦੇ ਟੂਰਿਸਟ ਆਏ ਹੁੰਦੇ ਹਨ ਇਵਨ ਕਿ ਦਰਬਾਰ ਸਾਹਿਬ 'ਚ ਤਾਂ ਫੋਰਨਰ ਬੜੇ ਆਉਂਦੇ ਆ ਇੰਨੀ ਸੰਗਤ ਆਉਂਦੀ ਹੈ ਇੰਨੀ ਸੰਗਤ ਆਉਂਦੀ ਹੈ ਅਤੇ ਆਨੰਦ ਹੀ ਆਨੰਦ ਮਿਲਦਾ ਇਸ ਤਰਾਂ ਲੱਗਦਾ ਕਿ ਇੰਨੀ ਸਾਫ਼ ਸਫ਼ਾਈ ਇੰਝ ਕਿ ਜਿਵੇਂ ਸਵਰਗ 'ਚ ਹੀ ਆ ਗਏ ਹਾਂ ਇੱਕ ਸਾਡੇ ਇੱਥੇ ਹੈਗਾ ਹੈ ਕਿ ਲੰਗੂਰਾਂ ਵਾਲਾ ਮੰਦਰ ਦੁਰਗਿਆਨਾ ਮੰਦਿਰ ਦੇ ਅੰਦਰ ਜਿਹਨੂੰ ਵੱਡਾ ਹਨੂੰਮਾਨ ਮੰਦਿਰ ਵੀ ਕਹਿੰਦੇ ਹਨ ਉਹ ਦੀ ਤਾਂ ਬਹੁਤ ਹੀ ਵਿਸ਼ੇਸ਼ਤਾਂ ਹੈ ਪੂਰੇ ਭਾਰਤ ਦੇ ਵਿੱਚ ਉਹ ਹਨੂੰਮਾਨ ਜੀ ਦਾ ਇੱਕੋ ਹੀ ਮੰਦਿਰ ਹੈ ਜਿੱਥੇ ਕਿ ਲੰਗੂਰ ਬਣਾਏ ਜਾਂਦੇ ਨੇ ਬੱਚਿਆਂ ਨੂੰ ਜਿਨ੍ਹਾਂ ਦੇ ਬੇਟੇ ਹੁੰਦੇ ਹੈ ਉਹ ਉਹਨਾਂ ਨੂੰ ਨਵਰਾਤਰਿਆਂ ਦੇ ਵਿੱਚ ਜਿਹੜੇ ਅਕਤੂਬਰ 'ਚ ਨਰਾਤੇ ਆਉਂਦੇ ਆ ਉੱਥੇ ਲੰਗੂਰ ਬਣਾਉਂਦੇ ਹਨ ਇੱਕ ਸਾਡੇ ਅੰਮ੍ਰਿਤਸਰ ਦੇ ਨਾਲ ਹੀ ਬਿਲਕੁਲ ਹੈ ਰਾਮ ਤੀਰਥ ਜਿੱਥੇ ਲਵ ਕੁਸ਼ ਦਾ ਜਨਮ ਹੋਇਆ ਸੀਤਾ ਜੀ ਉੱਥੇ ਵਾਲਮੀਕੀ ਜੀ ਦੇ ਆਸ਼ਰਮ 'ਚ ਰਹੇ ਇਹ ਸਭ ਚੀਜ਼ਾਂ ਇੱਕ ਵੱਖਰਾ ਹੀ ਤੁਹਾਨੂੰ ਆਨੰਦ ਦਿੰਦੀਆਂ ਨੇ ਅਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਵੀ ਕੁਛ ਇੰਨੀਆਂ ਨੇ ਨਾ ਕਿ ਹਰ ਕੋਈ ਚਾਹੁੰਦਾ ਹੈ ਕਿ ਉੱਥੇ ਜਾਏ